ਸਾਡਾ ਪੰਜਾਬ ਰਾਜ ਦਾ ਮੁੱਖ ਕਿੱਤਾ ਹੈ ਖੇਤੀਬਾੜੀ ਸਾਡੇ ਪੇਂਡੂ ਖੇਤਰ ਵਿੱਚ ਪਸ਼ੂ ਪਾਲਣ ਮੱਛੀ ਪਾਲਣ ਲੱਕੜ ਦਾ ਵਪਾਰ ਕੀਤਾ ਜਾਂਦਾ ਹੈ ਪਰ ਸਾਡਾ ਜ਼ਿਆਦਾਤਰ ਰੁਜ਼ਗਾਰ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ ਖੇਤੀਬਾੜੀ ਕਰਨ ਲਈ ਵੀ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਾਣੀ ਦੇ ਕਈ ਸਰੋਤ ਹਨ ਜਿਵੇਂ ਕਿ ਨਹਿਰਾਂ ਦਾ ਪਾਣੀ ਸਾਡੇ ਪੰਜਾਬ ਵਿੱਚ ਦਰਿਆ ਹਨ ਉਨ੍ਹਾਂ ਦਰਿਆਵਾਂ ਦਾ ਪਾਣੀ ਨਹਿਰਾਂ ਰਾਹੀਂ ਖੇਤਰਾਂ ਵਿ ਖੇਤਾਂ ਵਿੱਚ ਪਹੁੰਚਾਇਆ ਜਾਂਦਾ ਹੈ ਨਹਿਰਾਂ ਤੋਂ ਹਰ ਇੱਕ ਦੀ ਖੇਤੀ ਪਾਣੀ ਲਈ ਹੀ ਲਈ ਹੀ ਛੋਟੇ ਛੋਟੇ ਸੂਏ ਬਣਾਏ ਹਨ ਟਿਊਬਵੈਲ ਰਾਹੀਂ ਖੇਤੀ ਨੂੰ ਪਾਣੀ ਦਿੱਤਾ ਜਾਂਦਾ ਹੈ ਟਿਊਬਵੈਲ ਬਿਜਲੀ ਰਾਹੀਂ ਚੱਲਦੀ ਹੈ ਲਗਾਤਾਰ ਪਾਣੀ ਦਿੱਤਾ ਜਾਂਦਾ ਹੈ ਘਰ ਦਾ ਪਾਣੀ ਵੀ ਅਸੀਂ ਖੇ ਫਸਲਾਂ ਵਾਸਤੇ ਵਰਤਦੇ ਹਾਂ ਅਤੇ ਪਿੰਡਾਂ ਵਿੱਚ ਛੱਪੜ ਬਣਾਏ ਗਏ ਹਨ ਇਹਨਾਂ ਵਿੱਚ ਵੀ ਮੀਂਹ ਦਾ ਪਾਣੀ ਘਰਾਂ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਫਿਰ ਇਸ ਪਾਣੀ ਨੂੰ ਟੈਂਕਰਾਂ ਰਾਹੀਂ ਖੇਤਾਂ ਵਿੱਚ ਵਰਤਿਆ ਜਾਂਦਾ ਹੈ ਪਾਣੀ ਨੂੰ ਟੈਂਕਰਾਂ ਰਾਹੀਂ ਖੇਤਾਂ ਵਿੱਚ ਪਹੁੰਚਾਇਆ ਜਾਂਦਾ ਹੈ ਸਰਕਾਰ ਨੇ ਜਿੱਥੇ ਪਾਣੀ ਨਹੀਂ ਹੈ ਉੱਥੇ ਵੀ ਪਹੁੰਚਾਇਆ ਹੈ ਅਤੇ ਕਿ ਪਾਣੀ ਨੂੰ ਪਹੁੰਚਾਇਆ ਜਾਂਦਾ ਆਜ ਤਾਜ਼ੀ ਜ਼ਮੀਨ ਨੂੰ ਸਿੰਜਿਆ ਜਾ ਰਿਹਾ ਹੈ ਤਾਂ ਜੋ ਪਾਣੀ ਸਾਡਾ ਹੇਠਾਂ ਤੱਕ ਨਾ ਜਾਵੇ